ਮੇਰੇ ਜੀਵਨ ਦੌਰਾਨ ਟੈਕਨੋਲੋਜੀ ਨੇ ਇਸ ਸਮਾਜ ਵਿੱਚ ਬੜੀ ਤਬਦੀਲੀ ਲਿਆ ਦਿੱਤੀ ਹੈ ਜਿਵੇਂ ਕਿ ਮੋਬਾਇਲ ਫ਼ੋਨ ਦਾ ਆਵਿਸ਼ਿਕਾਰ ਹੋਇਆ ਇਸਦੇ ਦੌਰਾਨ ਬਹੁਤ ਸਹੁੂਲੀਅਤ ਲੋਕਾਂ ਨੂੰ ਮਿਲੀ ਉਹ ਘਰ ਬੈਠੇ ਹੀ ਕਿਸੇ ਪ੍ਰਕਾਰ ਦੀ ਗੂਗਲ ਦੇ ਉੱਤੇ ਨੌਲੇਜ ਲੈ ਸਕਦੇ ਹਨ ਕੋਈ ਵੀ ਚੀਜ਼ ਸਰਚ ਕਰਕੇ ਜੇ ਉਨ੍ਹਾਂ ਕਿਸੇ ਚੀਜ਼ ਖਾਣ ਪੀਣ ਦੀ ਵੀ ਔਡਰ ਕਰ ਸਕਦੇ ਨੇ ਘਰ ਹੀ ਬੈਠੇ ਆਨਲਾਈਨ ਹੀ ਪੇਅਮੈਂਟਾਂ ਕੀਤੀਆਂ ਜਾ ਸਕਦੀਆਂ ਨੇ ਜੇ ਉਹਨਾਂ ਨੇ ਕਿਤੇ ਬਾਹਰ ਜਾਣਾ ਹੈ ਮੀਂਹ ਪੈਂਦੇ ਦੌਰਾਨ ਉਹ ਘਰ ਬੈਠੇ ਹੀ ਊਬਰ ਟੈਕਸੀਆਂ ਵਰਗੀਆਂ ਨੂੰ ਮੋਬਾਇਲ ਦੇ ਉੱਤੇ ਉਹਨਾਂ ਟੈਕਸੀਆਂ ਨੂੰ ਬੁੱਕ ਕਰਕੇ ਆਪਣੇ ਸਥਾਨਾਂ ਉੱਤੇ ਆਪਣੀਆਂ ਮੰਜ਼ਿਲਾਂ ਉੱਤੇ ਜਾ ਸਕਦੇ ਹਨ